ਮੇਰਾ ਤਾਂ ਬਚਪਨ ਤੋਂ ਹੀ ਪੇਂਟਿੰਗ 'ਚ ਥੋੜ੍ਹਾ ਇੰਟਰਸਟ ਰਿਹਾ ਹੈ ਮੇ ਬੀ ਆ ਜਨਮ ਤੋਂ ਹੀ ਮਿਲਦਾ ਹੈ ਬਾਕੀ ਮੇਰੇ ਮਾਤਾ ਜੀ ਵੀ ਪੇਂਟਿੰਗ ਕਰਦੇ ਹਨ ਮੈਂ ਵੀ ਉਹਨਾਂ ਨੂੰ ਦੇਖਤੇ ਦੇਖਦੇ ਦੇਖਦੇ ਬਚਪਨ ਤੋਂ ਵੀ ਥੋੜ੍ਹਾ ਬਣਿਆ ਹਾਂ ਉਹ ਹੋ ਸਕਦਾ ਹੈ ਬਾਕੀ ਸਕੂਲ ਟਾਈਮ ਤੋਂ ਛੋਟੇ ਹੁੰਦੇ ਤੋਂ ਜਦੋਂ ਤੋਂ ਮੈਨੂੰ ਯਾਦ ਹੈ ਮੈਂ ਕੁਛ ਨਾ ਕੁਛ ਡਰਾਇੰਗ ਪੇਂਟਿੰਗ ਕਰਦਾ ਹੀ ਆ ਰਿਹਾਂ

ਸਿਖਲਾਈ ਤਾਂ ਮੈਂ ਤਾਂ ਕਿਤੋਂ ਨਹੀਂ ਸਿੱਖੀ ਮੈਨੂੰ ਕਿਉਂਕਿ ਸ਼ੌਂਕ ਸੀਗਾ ਮੈਂ ਬਚਪਨ ਤੋਂ ਆਪੇ ਕਰਦਾ ਆ ਰਿਹਾ ਆਪੇ ਕਰ ਕਰਕੇ ਸਿੱਖੀ ਹੈ ਦੇਖ ਕੇ ਕਰਕੇ ਟਾਈਮ ਦੇ ਨਾਲ ਥੋੜ੍ਹਾ ਬਿਹਤਰ ਹੁੰਦਾ ਗਿਆ ਅਤੇ ਹੋਰ ਮੀਡੀਅਮਸ ਟਰਾਏ ਕਰਦਾ ਗਿਆ ਪਹਿਲਾਂ ਪੈਂਨਸਲ ਸਕੈਚਿੰਗ ਕਰਦੇ ਸੀ ਫਿਰ ਰੰਗ ਭਰਨੇ ਸ਼ੁਰੂ ਕੀਤੇ ਓਇਲ ਪੇਂਟਿੰਗ ਟਰਾਏ ਕੀਤੀ ਐਕਰੇਲਿਕ ਪੇਂਟਿੰਗ ਟਰਾਏ ਕੀਤੀ ਵੋਟਰ ਕਲਰ ਟਰਾਏ ਕੀਤੇ ਕੰਪਿਊਟਰ ਡਿਜੀਟਲ ਵੀ ਟਰਾਏ ਕੀਤੇ ਪੋਸਟਰ ਮੇਕਿੰਗ ਗਰਾਫਿਕਸ ਪੇਂਟਿੰਗ ਐਵਰੀਥਿੰਗ ਉਹ ਸਭ 'ਚ ਥੋੜ੍ਹਾ ਇੰਟਰਸਟ ਹੈ ਉਹਦੇ ਤੋਂ ਹੀ ਮੇਰਾ ਕ੍ਰੀਏਟਿਵ ਫੀਲਡਸ ਵੱਲ ਹੀ ਇੰਟਰਸਟ ਸੀਗਾ ਇਸ ਲਈ ਮੇਰਾ ਪ੍ਰੋਫੈਸ਼ਨਲੀ ਵੀ ਮੈਂ ਆਰਕੀਟੈਕਚਰ ਫੀਲਡ ਵਿੱਚ ਆਇਆਂ ਬਾਕੀ ਪੇਂਟਿੰਗ ਵਿੱਚ ਮੈਨੂੰ ਨਹੀਂ ਲੱਗਦਾ ਸਿਖਲਾਈ ਜ਼ਰੂਰੀ ਹੈ ਮਤਲਬ ਬੰਦਾ ਆਪ ਵੀ ਸਿੱਖ ਸਕਦਾ ਹੈ ਜੇ ਕਿਸੇ ਦਾ ਇੰਟਰਸਟ ਹੈ ਉਹ ਆਪ ਵੀ ਸਿੱਖ ਸਕਦਾ ਹੈ ਅਤੇ ਜੇ ਕਿਸੇ ਨੂੰ ਲੱਗ ਰਿਹਾ ਹੈ ਕਿ ਹਾਂ ਸਕਿਲ ਵਾਈਜ ਮਤਲਬ ਸਕਿਲ ਸਕਿਲ ਦੇ ਹਿਸਾਬ ਨਾਲ ਇਹ 'ਚ ਕੁਛ ਕਮੀ ਹੈ ਕਈ ਟੈਕਨੀਕਲ ਚੀਜ਼ਾਂ ਹੁੰਦੀਆਂ ਜੋ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਹੈ ਜਿਹਦੇ ਨਾਲ ਪੇਂਟਿੰਗ ਬਿਹਤਰ ਹੁੰਦੀ ਹੈ ਉਹ ਹੋ ਸਕਦਾ ਹੈ ਕਿਸੇ ਨੂੰ ਅਗਰ ਔਖਾ ਲੱਗ ਰਿਹਾ ਤਾਂ ਉਹ ਸਿੱਖਣ ਲਈ ਜਾ ਸਕਦਾ ਹੈ ਪਰ ਮੈਨੂੰ ਤਾਂ ਕੋਈ ਲੋੜ ਲੱਗੀ ਨਹੀਂ ਕਦੇ ਨਾ ਹੀ ਪਈ ਮੈਂ ਆਪੇ ਹੀ ਕਰ ਕਰਕੇ ਸਿੱਖਿਆ